ਟੀ ਵੀ ਦਾ ਵਿਗਿਆਪਨ ਮੋਬਾਈਲ ਅਤੇ ਫੇਸਬੁੱਕ ਯੂਟੀਊਬ ਅਤੇ ਵਟਸਐੱਪ ਇੰਸਟਾਗਰਾਮ ਵਿਗਿਆਪਨ ਵਿੱਚੋਂ ਬਹੁਤ ਹੀ ਪ੍ਰਸਿੱਧ ਹੋ ਗਏ ਹਨ ਫੇਸਬੁੱਕ 'ਤੇ ਅਸੀਂ ਸਾਰੀ ਦੁਨੀਆ ਨੂੰ ਲਾਈਵ ਮਿਲਦੇ ਹਾਂ ਸਾਰੇ ਦੇਸ਼ਾਂ ਨੂੰ ਲਾਈਵ ਰਹਿਣ ਸਹਿਣ ਦੇਖਦੇ ਹਾਂ ਇੱਥੋਂ ਤੱਕ ਕਿ ਦੋ ਦੇਸ਼ਾਂ ਦੀ ਲੜਾਈ ਦੇ ਬਹੁਤ ਹੀ ਭਾਵੁਕ ਦ੍ਰਿਸ਼ ਜਿਵੇਂ ਯੂਕਰੇਨ ਅਤੇ ਰੂਸ ਦੀ ਲੜਾਈ ਦੇ ਸਾਰੇ ਦ੍ਰਿਸ਼ ਲਾਈਵ ਦੇਖਦੇ ਹਾਂ ਪਾਰਲੀਮੈਂਟ ਦੇ ਅੰਦਰ ਦੇ ਨਜ਼ਾਰੇ ਵੀ ਯੂਟੀਊਬ 'ਤੇ ਦੇਖਦੇ ਹਾਂ ਹਰ ਇੱਕ ਘਰ ਦਾ ਟੈਲੈਂਟ ਪ੍ਰਤਿਭਾ ਨਿਕਲ ਨਿਕਲ ਕੇ ਲਾਈਵ ਆਉਂਦੀ ਹੈ ਉਵੇਂ ਘਰ ਦੇ ਅੰਦਰ ਕੋਈ ਕਿਸੇ ਨੂੰ ਨਹੀਂ ਜਾਣਦਾ ਵਿਗਿਆਪਨ ਦੇ ਮਾਧਿਅਮ ਰਾਹੀਂ ਉਹ ਸਾਰੇ ਦੁਨੀਆ ਦੇ ਸਾਹਮਣੇ ਆ ਜਾਂਦੇ ਹਨ ਅੱਜ ਕੱਲ੍ਹ ਕੋਈ ਚੀਜ਼ ਖਰੀਦਣੀ ਜਾਂ ਵੇਚਣੀ ਹੋਵੇ ਤਾਂ ਔਨਲਾਈਨ ਰਾਹੀਂ ਅਸੀਂ ਝੱਟ ਖਰੀਦ ਸਕਦੇ ਹਾਂ ਜੇ ਅੱਜ ਕੱਲ੍ਹ ਕੋਈ ਚੀਜ਼ ਖਰੀਦਣੀ ਜਾਂ ਵੇਚਣੀ ਹੋਵੇ ਤਾਂ ਫੇਸਬੁੱਕ 'ਤੇ ਵਿਗਿਆਪਨ ਕਰਕੇ ਖਰੀਦਦਾਰ ਅਤੇ ਵੇਚਣ ਵਾਲਾ ਝੱਟ ਫੋਨ ਰਾਹੀਂ ਮਿਲ ਕੇ ਖਰੀਦਣ ਵਾਲਾ ਆਪਣੀ ਜ਼ਰੂਰਤ ਪੂਰੀ ਕਰ ਲੈਂਦਾ ਹੈ ਵੇਚਣ ਵਾਲਾ ਆਪਣਾ ਵਪਾਰ ਕਰ ਲੈਂਦਾ ਹੈ ਇੱਕ ਵਾਰੀ ਮੈਂ ਟੀ ਵੀ 'ਤੇ ਵਿਗਿਆਪਨ ਦੇਖਿਆ ਐਜੂਕੇਟ ਪੰਜਾਬ ਸੁਕਰਿਤ ਸੰਸਥਾ ਵੱਲੋਂ ਵਿਗਿਆਪਨ ਸੀ ਇਹ ਵਿਗਿਆਪਨ ਬਹੁਤ ਪ੍ਰਭਾਵਸ਼ਾਲੀ ਅਤੇ ਰਚਨਾਤਮਕ ਸੀ ਇਸ ਵਿੱਚ ਸੁਕਰਿਤ ਸੰਸਥਾ ਦੇ ਸੰਥਾਪਕ ਬਾਬਾ ਜੀ ਹਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਕੈਂਸਰ ਸੀ ਜਸਬੀਰ ਸਿੰਘ ਖੰਨੇ ਵਾਲਿਆਂ ਨੇ ਮੇਰੀ ਵਹੁਟੀ ਨੂੰ ਕਿਹਾ ਕਿ ਉਹ ਮੇਰੇ ਕੋਲ ਬੈਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨ ਮੇਰੀ ਵਹੁਟੀ ਮੇਰੇ ਕੋਲ ਬੈਠ ਕੇ ਰੋਜ਼ ਪਾਠ ਕਰਨ ਲੱਗ ਪਏ ਜਦੋਂ ਪਾਠ ਦਾ ਭੋਗ ਪਿਆ ਤਾਂ ਮੇਰੇ ਟੈਸਟ ਹੋਏ ਅਤੇ ਮੇਰੀ ਕੈਂਸਰ ਠੀਕ ਹੋ ਚੁੱਕੀ ਸੀ ਸਾਰੇ ਟੈਸਟ ਠੀਕ ਸਨ ਮੇਰੀ ਹੈਰਾਨੀ ਦੀ ਸੀਮਾ ਨਾ ਰਹੀ ਬਾਬਾ ਜੀ ਕਹਿੰਦੇ ਸਾਰੇ ਸੰਸਾਰ ਨੂੰ ਸਾਰੇ ਸਕੂਲਾਂ ਵਿੱਚ ਸਾਰੇ ਗੁਰਦੁਆਰਿਆਂ ਵਿੱਚ ਹਰ ਇੱਕ ਘਰ ਵਿੱਚ ਹੋਕਾ ਦਿੱਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਘਰ ਘਰ ਵਿੱਚ ਹੋਵੇ ਫਿਰ ਜਦੋਂ ਸਕੂਲਾਂ ਵਿੱਚ ਵਿਦਿਆਰਥੀ ਪਾਠ ਕਰਨ ਲੱਗ ਪਏ ਤਾਂ ਉਹਨਾਂ ਦੇ ਘਰਾਂ ਵਿੱਚੋਂ ਉਹਨਾਂ ਦੇ ਪਾਪਾ ਨੇ ਸ਼ਰਾਬ ਪੀਣੀ ਬੰਦ ਕਰ ਦਿੱਤੀ ਘਰਾਂ ਵਿੱਚੋਂ ਨਸ਼ੇ ਨਿਕਲ ਗਏ ਘਰਾਂ ਵਿੱਚ ਖੁਸ਼ਹਾਲੀ ਆ ਗਈ ਫਿਰ ਬੜੇ ਬੱਚੇ ਇੰਨੇ ਮਿਲੇ ਜਿਹੜੇ ਲਾਇਕ ਸੀ ਪਰ ਗਰੀਬ ਸੀ ਉਹ ਸਾਰੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸੁਕਰਿਤ ਸੰਸਥਾ ਵੱਲੋਂ ਹੋਣ ਲੱਗ ਪਿਆ ਬੱਚੇ ਬਾਣੀ ਵਿੱਚ ਵੀ ਜੁੜ ਗਏ ਇਮਾਨਦਾਰ ਡਾਕਟਰ ਇਮਾਨਦਾਰ ਆਈ ਏ ਐੱਸ ਔਫਿਸਰ ਬਣੇ ਇਹ ਸਾਰਾ ਕੁਝ ਟੀ ਵੀ ਦੇ ਵਿਗਿਆਪਨ ਦੇ ਪਲੇਟਫਾਰਮ ਦੇ ਕਾਰਨ ਹੀ ਹੋ ਪਾਇਆ ਹੁਣ ਮੈਂ ਬਹੁਤ ਪ੍ਰਭਾਵਿਤ ਹੋਈ ਇਸ ਵਿਗਿਆਪਨ ਤੋਂ ਮੈਂ ਬੱਚਿਆਂ ਨੂੰ ਪਾਠ ਸਿਖਾਉਂਦੀ ਕੀਰਤਨ ਸਿਖਾਉਂਦੀ ਅਤੇ ਬੱਚਿਆਂ ਦੀ ਪੜ੍ਹਾਈ ਉੱਤੇ ਪੈਸੇ ਲਗਾਉਂਦੀ ਹਾਂ ਬੱਚਿਆਂ ਦੇ ਸੰਸਕਾਰ ਵੀ ਬਹੁਤ ਵਧੀਆ ਬਣ ਰਹੇ ਹਨ ਆਤਮ ਨਿਰਭਰ ਹੋ ਰਹੇ ਹਨ ਪੜ੍ਹਾਈ ਵੀ ਕਰ ਰਹੇ ਹਨ ਸਿਲ ਸਿਲਾਈ ਵੀ ਸਿੱਖ ਰਹੇ ਹਨ ਕੰਪਿਊਟਰ ਵੀ ਸਿੱਖ ਰਹੇ ਹਨ ਇਹ ਸਾਰਾ ਕੁਝ ਵਿਗਿਆਪਨ ਕਰਕੇ ਹੀ ਸੰਭਵ ਹੋ ਸਕਿਆ ਹੈ